ਮੈਨੂੰ ਗੀਤ ਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਵੱਖ ਵੱਖ ਤਰ੍ਹਾਂ ਦੇ ਕਈ ਗੀਤ ਗਾਉਂਦਾ ਹਾਂ ਹਿੰਦੀ ਗੀਤ ਵੀ ਗਾ ਲੈਂਦਾ ਹਾਂ ਅਤੇ ਪੰਜਾਬੀ ਗੀਤ ਵੀ ਗਾ ਲੈਂਦਾ ਹਾਂ ਮੈਂ ਖੁਦ ਵੀ ਗੀਤ ਲਿਖ ਲੈਂਦਾ ਹਾਂ ਅਤੇ ਉਹਨਾਂ ਨੂੰ ਗਾਉਣ ਗਾਉਂਦਾ ਹਾਂ ਵੈਸੇ ਹਿੰਦੀ ਫਿਲਮਾਂ ਗੀਤ ਮੈਂ ਬਹੁਤ ਗਾਉਂਦਾ ਹਾਂ ਮੈਂ ਸੋਨੂੰ ਨਿਗਮ ਬਹੁਤ ਪਸੰਦ ਹੈ ਸੋ ਮੈਂ ਵ ਉਸ ਦੇ ਗੀਤ ਗਾਦਾ ਗਾਉਣਾ ਵੀ ਪਸੰਦ ਕਰਦਾ ਹਾਂ